ਸਤਿ ਸ਼੍ਰੀ ਅਕਾਲ ਤੁਸੀਂ ਚਾਵਲਾ ਰੈਸਟੋਰੈਂਟ ਤੋਂ ਬੋਲ ਰਹੇ ਹੋ ਅਸੀਂ ਆਪਣੇ ਲਈ ਕੁਛ ਆਈਟਮਸ ਮੰਗਾਉਣੀਆਂ ਸੀ ਤੁਹਾਡੇ ਉੱਥੋਂ ਤੁਸੀਂ ਸਾਨੂੰ ਕਿੰਨੇ ਕੁ ਟਾਈਮ ਤੱਕ ਸੈਂ ਮਤਲਬ ਭੇਜ ਦੋਗੇ ਹਾਂਜੀ ਅਤੇ ਫਿਰ ਮੈਂ ਤੁਹਾਨੂੰ ਲਿਖਵਾ ਦਿੰਦੀ ਹਾਂ ਜੋ ਜੋ ਅਸੀਂ ਮੰਗਵਾਉਣਾ ਹਾਂਜੀ ਲਿਖ ਲਓ ਸ਼ਾਹੀ ਪਨੀਰ ਮਿਕਸ ਵੈੱਜ ਦਾਲ ਮੱਖਣੀ ਚਾਵਲ ਰੋਟੀ ਅਤੇ ਮਿੱਠੇ ਵਿੱਚ ਮੈਂ ਗੁਲਾਬ ਜਾਮਨ ਖਾਣਾ ਪਸੰਦ ਕਰੂੰਗੀ ਅਤੇ ਦੋ ਕੋਲਡ ਡਰਿੰਕਸ ਕੋਕ ਦੀਆਂ ਹਾਂਜੀ ਹਾਂਜੀ ਤੁਸੀਂ ਮੈਨੂੰ ਬਿੱਲ ਬਣਾ ਕੇ ਭੇਜ ਦਿਓ ਕਿੰਨਾ ਬਿੱਲ ਬਣਿਆ ਤੁਸੀਂ ਥੋੜ੍ਹਾ ਡਿਸਕਾਊਂਟ ਦਿਉਂਗੇ ਸਾਨੂੰ ਹਾਂਜੀ ਅਤੇ ਥਰੀ ਬੀ ਵਨ ਰੋ ਰੋਜ਼ ਗਾਰਡਨ ਹੈ ਹਾਂਜੀ ਉੱਥੇ ਆ ਕੇ ਤੁਸੀਂ ਮੈਨੂੰ ਇਸ ਨੰਬਰ 'ਤੇ ਕੋਲ ਕਰ ਦਿਓ ਅਸੀਂ ਆਪਣਾ ਔਡਰ ਪਿਕ ਕਰ ਲਵਾਂਗੇ ਹਾਂਜੀ ਸ ਧੰਨਵਾਦ ਜੀ